ਹੈਲੋ ਸਤਿ ਸ਼੍ਰੀ ਅਕਾਲ ਜੀ ਅਸਲ 'ਚ ਅਸੀਂ ਇੱਕ ਟੂਰ 'ਤੇ ਜਾਣਾ ਹੈ ਤਾਂ ਉਸਦੇ ਰਿਲੇਟਿਡ ਅਸੀਂ ਅਸਲ ਚ ਅਸੀਂ ਪਹਾੜਾਂ ਵੱਲ ਜਾਣਾ ਚਾਹੁੰਦੇ ਹਾਂ

ਪਰ ਟਰੇਨ ਦਾ ਸਫ਼ਰ ਜ਼ਿਆਦਾ ਕੰਫਰਟੇਬਲ ਲੱਗਦਾ ਸਾਨੂੰ ਕਾਰ ਨਾਲੋਂ ਹਾਂਜੀ ਉਹ ਅ ਉਹ ਤਾਂ ਜ਼ਰੂਰ ਦੱਸਣ ਨਾਲ ਨਾਲ ਆਹ ਵੀ ਦੱਸ ਦਿਓ ਕਿ ਪੇਮੈਂਟ ਵਗੈਰਾ ਕਿਵੇਂ ਹੋਵੇਗੀ ਖਰਚਾ ਕਿੰਨਾ ਹੋਵੇਗਾ ਅਤੇ ਹਾਂਜੀ ਹਾਂਜੀ

ਹਾਂਜੀ ਹਾਂਜੀ ਹਾਂਜੀ

ਅੱਜ ਕਿੰਨੇ ਦਿਨਾਂ ਦਾ ਹੋਵੇਗਾ ਪਰ ਕਿੰਨੇ ਦਿਨ ਅਤੇ ਕਿੰਨੇ ਰਾਤ ਦਾ ਟੂਰ ਠੀਕ ਰਹੇ ਤਿੰਨ ਦਿਨ ਦਾ ਤਿੰਨ ਦਿਨ ਦਾ ਹਾਂਜੀ

ਡਿਸਕਾਊਂਟ ਵਗੈਰਾ ਅਵੇਲੇਬਲ ਹੋ ਸਕਦਾ ਹਾਂਜੀ

ਹਾਂਜੀ ਹਾਂਜੀ ਜ਼ਰੂਰ ਚਰਨ ਦਾ ਵਾ